ਰੋਜ਼ਾਨਾ ਜੀਵਨ ਵਿੱਚ ਤਕਨੀਕੀ ਸਾਧਨ ਤਾਂ ਬਹੁਤ ਹਨ ਪਰ ਉਹਨਾਂ ਵਿੱਚੋਂ ਵੀ ਉਪਯੋਗੀ ਅਜਿਹੇ ਹੁੰ ਕੁਝ ਅਜਿਹੇ ਹਨ ਜਿਹਨਾਂ ਬਿਨਾਂ ਬਿਲਕੁਲ ਨਹੀਂ ਸਰਦਾ ਪੱਖਾ ਪੱਖੇ ਬਿਨਾਂ ਤਾ ਚੱਲ ਹਵਾ ਲੈ ਲਾਂਗੇ ਲਾਈਟ ਨਾ ਹੋਈ ਤਾਂ ਬਿਨਾਂ ਪ ਪੱਖੇ ਤੋਂ ਬੈਠਣਾ ਪੈਂਦਾ ਹੈ ਪਰ ਸੀਡੀ ਪਲੇਅਰ ਇੱਕ ਅਜਿਹੀ ਚੀਜ਼ ਹੈ ਕਿ ਬੰਦੇ ਦਾ ਸਹਾਰਾ ਹੁੰਦਾ ਹੈ ਮਨੋਰੰਜਨ ਹੁੰਦਾ ਹੈ ਵਿਹਲਾ ਬੈਠਾ ਟਾਈਮ ਪਾਸ ਹੋ ਜਾਂਦਾ ਵਿਹਲੇ ਬੈਠੇ ਬੰਦੇ ਦਾ ਆਪਾਂ ਕੋਈ ਫਿਲਮ ਵੇਖ ਲੈਂਦਾ ਕੋਈ ਨਾਟਕ ਵਗੈਰਾ ਵੇਖ ਲੈਂਦਾ ਕੋਈ ਵੀ ਕ ਕੋਈ ਆਪਣੀ ਪਸੰਦ ਦੇ ਕੋਈ ਚੀਜ਼ ਬਣਾਉਣੀ ਕਰਨੀ ਕੁਛ ਵੀ ਦੇਖ ਸਕਦੇ ਹਾਂ ਸੀਡੀ ਪਲੇਅਰ 'ਤੇ ਕੋਈ ਮੂਵੀ ਵੇਖ ਸਕਦੇ ਹਾਂ ਕੋਈ ਕੋਈ ਆਪਦੇ ਮੈਰਿਜ਼ ਦੀ ਵੀ ਕੋਈ ਦੇਖ ਸਕਦੇ ਹਾਂ ਮੂਵੀ ਕੁਛ ਵੀ ਦੇਖ ਸਕਦੇ ਹਾਂ ਮਨੋਰੰਜਨ ਜਿੰਨਾ ਮਰਜ਼ੀ ਕਰ ਸਕਦੇ ਹਾਂ ਕੁਰਸੀ ਆ ਕੁਰਸੀ 'ਤੇ ਦਸ ਮਿੰਟ ਬੈਠ ਕੇ ਆਰਾਮ ਕਰ ਸਕਦੇ ਹਾਂ ਕਰ ਸਕਦੇ ਹਾਂ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਸੀਡੀ ਪ੍ਰੇਅਰ ਦਾ ਬਹੁਤ ਜ਼ਿਆਦਾ ਲਾਭ ਹਨ ਬਹੁਤ ਜ਼ਿਆਦਾ ਮਨ ਮਨੋਰੰਜਨ ਹੁੰਦਾ ਹੈ ਇਹਦੇ 'ਤੇ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜਾ ਸਕਦੀਆਂ ਹਨ ਜੋ ਮਰਜ਼ੀ ਦੇਖ ਸਕਦੇ ਹਾਂ